ਹੈਲੋ ਤੋਂ ਬੋਲ ਰਹੇ ਹੋ ਜੀ ਅੱਛਾ ਵਧੀਆ ਜੀ ਵਧੀਆ ਜੀ ਤੁਹਾਡੀ ਦੁਕਾਨ ਦਾ ਬੜਾ ਨਾਮ ਸੁਣਿਆ ਅਤੇ ਹੁਣ ਝੋਨੇ ਦਾ ਮਤਲਬ ਚੱਲ ਰਿਹਾ ਸੀਜਨ ਜੀ ਸਾਡੇ ਪਨੀਰੀ ਦੀ ਕਾਫ਼ੀ ਸਮੱਸਿਆ ਆਉਂਦੀ ਹਰੇਕ ਵਾਰ ਅਤੇ ਅਸੀਂ ਮਤਲਬ ਤੁਹਾਡੇ ਤੋਂ ਚਾਹੁੰਦੇ ਹਾਂ ਵੀ ਸਾਡੀ ਪਨੀਰੀ ਨੂੰ ਕੋਈ ਪ੍ਰੋਬਲਮ ਨਾ ਆਵੇ ਅਤੇ ਜਿਹੜੀ ਆ ਗਰੋਥ ਆ ਵਧੀਆ ਹੋਵੇ ਉਹਦੇ ਵਾਸਤੇ ਤੁਸੀਂ ਕੀ ਸੁਜੇਸਟ ਕਰਦੇ ਹੋ ਸਾਨੂੰ ਜੀ ਠੀਕ ਹੈ ਜੀ ਅੱਜ ਨਾ ਜੀ ਜਿਹੜੀਆਂ ਮਤਲਬ ਸਿਫਾਰਿਸ਼ਾਂ ਦੀ ਗੱਲ ਦੇਖੋ ਮੈਂ ਵੀ ਪੜ੍ਹਿਆ ਲਿਖਿਆ ਕਿਸਾਨ ਹਾਂ ਮਤਲਬ ਇੱਕ ਜਿਹੜਾ ਪੁਰਾਣਾ ਜ਼ਮਾਨਾ ਸੀ ਉਦੋਂ ਤਾਂ ਮਤਲਬ ਜਿਵੇਂ ਦੁਕਾਨਦਾਰ ਗਾਈਡ ਕਰਦਾ ਸੀ ਅਸੀਂ ਸਾਡੇ ਜਿਹੜੇ ਕਿਸਾਨ ਸੁਣ ਲੈਂਦੇ ਸੀ ਅਤੇ ਅੱਜ ਜਿਹੜੀ ਹਾਲਤ ਹੈ ਉਹ ਮਤਲਬ ਯੂਨੀਵਰਸਿਟੀਆਂ ਜਾਂ ਸਰਕਾਰ ਆ ਉਹ ਵੀ ਲੈ ਦੇ ਕਰਕੇ ਕਾਫ਼ੀ ਸਾਰੀਆਂ ਜਿਹੜੀਆਂ ਮਤਲਬ ਉਹ ਕਰਦੀ ਹੈਗੀ ਹੈ ਅਪਰੂਵਲਾਂ ਦੇ ਦਿੰਦੀ ਹੈ ਔਰਗੈਨਿਕ ਤਰੀਕੇ ਦੇ ਨਾਲ ਜਿਹੜੀ ਅਸ ਅਸੀਂ ਚਾਹੁੰਦੇ ਹਾਂ ਵੀ ਕੋਈ ਸਿਸਟਮ ਤੁਸੀਂ ਸਾਨੂੰ ਵਧੀਆ ਗਾਈਡ ਕਰੋ ਨਾ ਤਾਂ ਉਹਦੇ ਨਾਲ ਸਾਨੂੰ ਇਹ ਫ਼ਾਇਦਾ ਹੋਵੇ ਵੀ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਗਰੋਥ ਹੋ ਸਕੇ ਬਿਮਾਰੀ ਨਾ ਪਵੇ ਕੀੜੀ ਬਹੁਤ ਪੈਂਦੀ ਹੈ ਅਤੇ ਜਿਹੜੀਆਂ ਜੜਾਂ ਉਹ ਮਤਲਬ ਕਾਲੀਆਂ ਹੁੰਦੀਆਂ ਗ੍ਰੋ ਲਗਰਾਂ ਨਹੀਂ ਨਿਕਲਦੀਆਂ ਉਹਦੀਆਂ ਝੋਨੇ ਦੀਆਂ ਜਦੋਂ ਅਸੀਂ ਪਨੀਰੀ ਲਾ ਦਿੰਦੇ ਆ ਜੀ ਅਤੇ ਇੱਕ ਪੀਲੀ ਬੜੀ ਪੈ ਜਾਂਦੀ ਹੈ ਅਤੇ ਇਹਦੇ ਵਾਸਤੇ ਤੁਹਾਡੇ ਕੋਲ ਪੁਖਤਾ ਪ੍ਰਬੰਧ ਹੈਗੇ ਜੀ ਵਧੀਆ ਪ੍ਰਬੰਧ ਹੈਗੇ

ਠੀਕ ਹੈ ਜੀ ਅਤੇ ਪੇਮੈਂਟ ਦਾ ਵੀ ਸ਼ਡਿਊਲ ਰਹੁੰਗਾ ਜੀ ਤੁਹਾਡਾ ਪੇਮੈਂਟ ਦੀ ਕੀ ਸ਼ਡਿਊਲ ਕਰੋਗੇ ਕਿਵੇਂ ਕਰੋਗੇ ਸਾਡਾ ਕਿਉਂਕਿ ਸਮਾਂ ਮਤਲਬ ਸਿਸਟਮ ਇਹ ਹੁੰਦਾ ਵੀ ਛੇ ਮਹੀਨਿਆਂ ਬਾਅਦ ਅਸੀਂ ਕਰਦੇ ਹਾਂ ਵੀ ਕੁਛ ਪੇਮੈਂਟ ਆਪਾਂ ਐਡਵਾਂਸ ਕਰ ਲਈਏ ਅਤੇ ਕੁਛ ਆਪਾਂ ਮਤਲਬ ਬਾਅਦ 'ਚ ਕਰ ਲਈਏ ਫਸਲ ਵੇਲੇ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਮਤਲਬ ਦਿੱਕਤ ਹੈ ਜਾਂ ਆਪਾਂ ਕਿਵੇਂ ਕਰੀਏ ਫਿਫਟੀ ਪਰਸੈਂਟ ਅਸੀਂ ਪੇ ਕਰ ਦਿਆਂਗੇ ਕੈਸ਼ ਕਰੀਏ ਕਿ ਤੁਹਾਨੂੰ ਮਤਲਬ ਬਾਏ ਚੈੱਕ ਦੇ ਦੇਈਏ ਕੋਈ ਦਿੱਕਤ ਨਹੀਂ ਮਤਲਬ ਇੱਕ ਨੰਬਰ ਖਾਤੇ 'ਚ ਜਾ ਬੜੇ ਕੋਈ ਚੱਕਰ ਨਹੀਂ ਕਿ ਮਤਲਬ ਤੁਹਾਨੂੰ ਕੈਸ਼ ਹੀ ਦੇਈਏ ਠੀਕ

ਠੀਕ ਹੈ ਜੀ ਕੋਈ ਨਹੀਂ ਫਿਰ ਮੈਂ ਕਰਦਾ ਆਪਣੇ ਬੇਟੇ ਨਾਲ ਰਾਏ ਕਰਦਾ ਅਤੇ ਤੁਹਾਨੂੰ ਫਿਰ ਅਸੀਂ ਪੰਜਾਹ ਕਿੱਲਿਆਂ ਦਾ ਔਡਰ ਪਲੇਸ ਕਰਦੇ ਹਾਂ ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਥੈਂਕ ਯੂ